ਪੰਜਾਬੀਆਂ ਦੇ ਹਰਮਨ ਪਿਆਰੇ ਅਖ਼ਬਾਰ ਅਜੀਤ ਨੂੰ ਇਕੱਲੇ ਭਾਰਤ ਵਿੱਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਸ਼ ਵਿੱਚ ਪੰਜਾਬੀ ਵਿੱਚ ਸਭ ਤੋਂ ਵੱਧ ਛਪਣ ਵਾਲਾ ਅਖ਼ਬਾਰ ਹੋਣ ਦਾ ਪੁਰਸਕਾਰ ਮਿਲਿਆ ਹੈ ਅਜੀਤ ਅਖ਼ਬਾਰ ਵਿੱਚ ਸਾਨੂੰ ਰੋਜ਼ ਰੋਜ਼ ਨਵੀਆਂ ਨਵੀਆਂ ਐਡਵਟਾਇਜਮੈਂਟਸ ਅਧਿਕ ਰੂਪ ਵਿੱਚ ਨੌਕਰੀਆਂ ਬਾਰੇ ਅਤੇ ਬਹੁਤ ਹੀ ਜਾਣਕਾਰੀਆਂ ਪ੍ਰਾਪਤ ਹੁੰਦੀਆਂ ਹਨ ਜੋ ਕਿ ਸਾਨੂੰ ਬਹੁਤ ਹੀ ਮਦਦ ਕਰਦੀਆਂ ਹਨ ਅਜੀਤ ਅਖ਼ਬਾਰ ਨੂੰ ਪੂਰੇ ਭਾਰਤ ਵਿੱਚ ਸੱਭ ਤੋਂ ਵੱਧ ਛਪਣ ਵਾਲੀ ਅਖ਼ਬਾਰ ਵਿੱਚੋਂ ਮੰਨਿਆ ਜਾਂਦਾ ਹੈ ਜਿਸ ਵਿੱਚ ਬਹੁਤ ਹੀ ਨੌਕਰੀਆਂ ਬਾਰੇ ਦੱਸਿਆ ਜਾਂਦਾ ਹੈ ਅਤੇ ਲੋਕਾਂ ਨੂੰ ਆਪਣੀਆਂ ਮੁਸ਼ਕਿਲਾਂ ਹੱਲ ਕਰਨ ਦਾ ਰਾਹ ਵੀ ਦੱਸਿਆ ਜਾਂਦਾ ਹੈ ਅਜੀਤ ਅਖ਼ਬਾਰ ਨੂੰ ਸਾਰੇ ਭਾਰਤ ਵਿੱਚੋਂ ਜ਼ਿਆਦਾ ਛਪਣ ਦਾ ਅਵੋਡ ਵੀ ਮਿਲਿਆ ਹੈ ਧੰਨਵਾਦ